ਮੈਨੂੰ ਸ਼ੱਕ ਹੈ ਇਸ ਵਾਰ ਬਿਜਲੀ ਬਿਲ ਭੁਗਤਾਨ ਕਰਨ ਵਿੱਚੋਂ ਮੇਰੇ ਤੋਂ ਗਲਤੀਆਂ ਹੋ ਸਕਦੀਆਂ ਹਨ ਇਸ ਬਾਰੇ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਮੈਂ ਪਿਛਲੀ ਵਾਰ ਬਿੱਲ ਕਿਵੇਂ ਭਰੇ ਅਤੇ ਮੇਰਾ ਕਿੰਨਾ ਬਿਲ ਭਰਿਆ ਗਿਆ ਅਤੇ ਕਿੰਨਾ ਬਿੱਲ ਰਹਿ ਗਿਆ ਇਸ ਵਾਰ ਨਵਾਂ ਬਿੱਲ ਭਰਨ 'ਚ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ ਅਤੇ ਮੈਂ ਆਪਦੇ ਦੋਸਤ ਨਾਲ ਗੱਲ ਕੀਤੀ ਮੇਰੇ ਦੋਸਤ ਨੇ ਮੈਨੂੰ ਨਜ਼ਦੀਕੀ ਬਿਜਲੀ ਬੋਰਡ ਸ਼ਾਖਾ ਦਫਤਰ ਬਾਰੇ ਦੱਸਿਆ ਕਿ ਤੁਸੀਂ ਉੱਥੇ ਜਾਓ ਆਪਣੀ ਗੱਲ ਬਿਜਲੀ ਬੋਰਡ ਦੇ ਨੁਮਾਇੰਦੇ ਨਾਲ ਕਰੋ ਫਿਰ ਮੈਂ ਬਿਜਲੀ ਬੋਰਡ ਵਾਲਿਆਂ ਦੇ ਦਫਤਰ ਗਿਆ ਮੈਂ ਉਹਨਾਂ ਦੇ ਨੁਮਾਇੰਦੇ ਨਾਲ ਗੱਲ ਕੀਤੀ ਮੈਂ ਆਪਦਾ ਨਵਾਂ ਬਿੱਲ ਭਰਨ ਆਇਆ ਹਾਂ ਮੇਰੇ ਤੋਂ ਨਵੇਂ ਬਿੱਲ ਵਿੱਚ ਭਰਨ 'ਚ ਕੋਈ ਗਲਤੀ ਨਾ ਹੋ ਜਾਵੇ ਇਸ ਕਰਕੇ ਮੈਨੂੰ ਪਿਛਲੇ ਤਿੰਨ ਮਹੀਨਿਆਂ ਦੇ ਬਿੱਲ ਦਾ ਵੇਰਵਾ ਦਿਓ ਤਾਂ ਕਿ ਪਿਛਲੇ ਬਿੱਲ ਮੈਂ ਕਿਵੇਂ ਭਰੇ ਸੀ ਮੈਂ ਮੈਨੂੰ ਕਿੰਨਾ ਬਿਲ ਦੇਣਾ ਆਉਂਦਾ ਹੈ ਕਿੰਨਾ ਨਹੀਂ ਫਿਰ ਮੈਂ ਆਪਦਾ ਬਿੱਲ ਭਰਾਂਗਾ